ਹਾਂ ਮੇਰਾ ਮੈਂ ਹਿੰਦੂ ਕਾਸਟ ਨਾਲ ਸੰਬੰਧ ਰੱਖਦਾ ਜੀ ਅਤੇ ਮੈਂ ਬਿਲਕੁਲ ਠੀਕ ਹੈ ਕਿ ਮੇਰਾ ਧਰਮ ਅ ਤਾਂ ਇਹੋ ਹੀ ਕਹਿੰਦਾ ਕਿ ਸਮਾਜ ਸੇਵਾ ਹੋਣੀ ਚਾਹੀਦੀ ਕਿਸੇ ਦਾ ਭਲਾ ਹੋ ਸਕੇ ਤਾਂ ਜ਼ਰੂਰ ਭਲਾ ਕਰਨਾ ਚਾਹੀਦਾ ਅਤੇ ਮੈਂ ਇਹਨੂੰ ਇਹਦਾ ਮੈਨੂੰ ਤਾਂ ਇਹ ਚੀਜ਼ ਦਾ ਬਿਲ ਬਹੁਤ ਸ਼ੌਂਕ ਹੈ ਕਿ ਜੇ ਮੈਂ ਗੁਰਦੁਆਰੇ ਜਾਵਾਂ ਜਾਂ ਮੰਦਰ ਜਾਵਾਂ ਜਾਂ ਕਿਸੇ ਗਰੀਬ ਦੀ ਕਿਸੇ ਦੀ ਤ ਧਨ ਨਾਲ ਕਿਸੇ ਦੀ ਧਨ ਨਾਲ ਕਹਿੰਦੇ ਨਾ ਪੈਸੇ ਨਾਲ ਅਤੇ ਕਿਸੇ ਦੀ ਮਨੋ ਤਨ ਮਨ ਧਨ ਨਾਲ ਸੇਵਾ ਕਰਨੀ ਚਾਹੀਦੀ ਹੈ ਜੇ ਕੋਈ ਗਰੀਬ ਆਦਮੀ ਜੇ ਕੋਈ ਬੰਦਾ ਕੋਈ ਵੇਖਿਆ ਜੇ ਕੋਈ ਨੀਡੀ ਹੈਗਾ ਤਾਂ ਉਹਨੂੰ ਅਸੀਂ ਪੈਸਾ ਧੇਲਾ ਜੇ ਕਿਸੇ ਨੂੰ ਤੁਸੀਂ ਪੈਸਾ ਧੇਲਾ ਵੀ ਨਹੀਂ ਦੇ ਸਕਦੇ ਤਾਂ ਕਿਸੇ ਨੂੰ ਜੇ ਤੁਸੀਂ ਮਿੱਠੇ ਬੋਲ ਬੋਲ ਦਿਓ ਉਹ ਵੀ ਸੇਵਾ ਦਾ ਹੀ ਰੂਪ ਆ ਉਹਨੂੰ ਹੌਸਲਾ ਅਫਜਾਈ ਕਰ ਦਿਓ ਤਾਂ ਉਹ ਵੀ ਅਸੀਂ ਇੱਕ ਸੇਵਾ ਹੀ ਗਿਣੀ ਜਾਂਦੀ ਹੈ ਉਹਦਾ ਉਹਦਾ ਉਹਨੂੰ ਹੌਸਲਾ ਦੇ ਦਿਓ ਵੀ ਤੂੰ ਇਹ ਕੰਮ ਕਰ ਸਕਦਾ ਤੂੰ ਇਹ ਕੰਮ ਕਰ ਉਹ ਉਹ ਵੀ ਗਰੀਬੀ ਤੋਂ ਵੀ ਉੱਠ ਸਕਦਾ ਅਤੇ ਸਾਡਾ ਧਰਮ ਤਾਂ ਇਹੋ ਹੀ ਕਹਿੰਦਾ ਵੀ ਜਿੱਥੇ ਜਿਸ ਵੇਲੇ ਬਣੇ ਕਿ ਸੇਵਾ ਕਿਸੇ ਸਮਾਜ ਸੇਵਾ ਕਰਨੀ ਓ ਚਾਹੀਦੀ ਹੈ ਅਤੇ ਅਸੀਂ ਸਮਾਜ ਸੇਵਾ ਦੇ ਵਿੱਚ ਕਈ ਤਰੀਕੇ ਹਨ ਤੁਸੀਂ ਮੰਦਰ ਜਾ ਕੇ ਗਏ ਜੇ ਕਿਸੇ ਇੱਕ ਤੁਹਾਡੀ ਆਂਢੀ ਗੁਆਂਢੀ ਕੋਈ ਜੇ ਗਰੀਬ ਜਨਾਨੀ ਹੈ ਮੰਨ ਲਓ ਉਹਨਾਂ ਕੋਲ ਪਾਉਣ ਵਾਸਤੇ ਕੱਪੜਾ ਨਹੀਂ ਹੈਗਾ ਤੁਸੀਂ ਉਹਦਾ ਤਨ ਢੱਕ ਸਕਦੇ ਹੋ ਇਹ ਵੀ ਸੇਵਾ ਹੀ ਹੈ ਜੇ ਕਿਸੇ ਬਿਮਾਰ ਆਦਮੀ ਨੂੰ ਕਿਸੇ ਨੂੰ ਦਵਾਈ ਚਾਹੀਦੀ ਹੈ ਤਾਂ ਉਹਨੂੰ ਤੁਸੀਂ ਦਵਾਈ ਲੈ ਦਿਓ ਇਹ ਵੀ ਤਾਂ ਸੇ ਸੇਵਾ ਹੀ ਹੈ ਸਮਾਜ ਸੇਵਾ ਸੇਵਾ ਦਾ ਤਾਂ ਕਈ ਰੂਪ ਹੈ ਤੁਸੀਂ ਉਹਨੂੰ ਔਰ ਜੇ ਉਹ ਦੁਖੀ ਹੈ ਵੈਸੇ ਹੀ ਆਹ ਪੁੱਤਰ ਗਰੋਹ ਵੈਸੇ ਤਾਂ ਸਾਰਾ ਸੰਸਾਰ ਹੀ ਦੁਖੀ ਹੈ ਕੋਈ ਪੁੱਤਰ ਤੋਂ ਦੁਖੀ ਕੋਈ ਧੀ ਤੋਂ ਦੁਖੀ ਕੋਈ ਸਰੀਰ ਤੋਂ ਦੁਖੀ ਹਾਂਜੀ ਅਤੇ ਲੇਕਿਨ ਅਹ ਕਿਸੇ ਨੂੰ ਵੀ ਤੁਸੀਂ ਕਿਸੇ ਤਰ੍ਹਾਂ ਵੀ ਤਸੱਲੀ ਦੇ ਦਿਓ ਜੇ ਧਨ ਦੀ ਲੋੜ ਹੈ ਉਹਨੂੰ ਧਨ ਦੇ ਦਿਓ ਦਵਾਈ ਦੀ ਲੋੜ ਹੈ ਦਵਾਈ ਦੇ ਦਿਓ ਜੇ ਵੈਸੇ ਵੀ ਉਹ ਪਰੇਸ਼ਾਨ ਆ ਉਹਨੂੰ ਤੁਸੀਂ ਅ ਸਤਾਵਨਾ ਦੇ ਦਿਓ ਉਹਨੂੰ ਹੌਸਲਾ ਦੇ ਦਿਓ ਅਤੇ ਇਹ ਵੀ ਸੇਵਾ ਦੇ ਤਾਂ ਕਈ ਰੂਪ ਹੈ ਇਸ ਤਰ੍ਹਾਂ ਹਰਪ੍ਰੀਤ ਸਿੰਘ ਜਿਸ ਤਰ੍ਹਾਂ ਵੀ ਬਣੇ ਬੰਦੇ ਨੂੰ ਆਪਣੀ ਸੇਵਾ ਇਸ ਤਰ੍ਹਾਂ ਦੇ ਸਮਾਜ ਵਿੱਚ ਰਹਿ ਕੇ ਇੱਕ ਦੂਜੇ ਦੀ ਹੈਲਪ ਕਰਕੇ ਸੇਵਾ ਕਰਨੀ ਚਾਹੀਦੀ ਹੈ ਸ਼ੁਕਰੀਆ